ਕਾਫੀ ਸਮੇਂ ਤੋਂ ਮੈਂ ਆਪਣੇ ਲਈ ਔਨਲਾਈਨ ਸ਼ੂਅ ਖਰੀਦਣਾ ਚਾਹੁੰਦਾ ਸੀ ਫਿਰ ਮੈਂ ਇੱਕ ਦਿਨ ਮਨ ਬਣਾਇਆ ਕਿ ਮੈਂ ਆਪਣਾ ਜਿਹੜਾ ਸ਼ੂਅ ਹੈ ਔਨਲਾਈਨ ਖਰੀਦ ਲਵਾਂ ਅਤੇ ਫਿਰ ਮੈਂ ਕੀ ਕੀਤਾ ਮੈਂ ਨਾ ਆਪਦੀ ਜਿਹੜੀ ਗੂਗਲ ਪੇਅ ਨੂੰ ਚੈੱਕ ਕਰਾਂ ਵੀ ਮੇਰੇ ਕੋਲ ਬਕਾਇਆ ਹੈ ਜਾਂ ਨਹੀਂ ਹੈ ਤਾਂ ਫਿਰ ਮੈਂ ਕਿਹਾ ਵੀ ਚਲੋ ਆਪਾਂ ਗੂਗਲ ਪੇਅ ਨੂੰ ਆਪਦੇ ਅਕਾਊਂਟ ਨੂੰ ਚੈੱਕ ਕਰਦੇ ਹਾਂ ਵੀ ਬੈਲੈਂਸ ਹੈਗਾ ਹੈ ਨਹੀਂ ਗਾ ਫਿਰ ਮੈਂ ਆਪਣਾ ਮੋਬਾਈਲ ਚੁੱਕਿਆ ਅਤੇ ਮੋਬਾਇਲ ਦੀ ਸਕਰੀਨ ਦੇ ਉੱਪਰ ਮੇਰਾ ਚਾਰ ਅੰਕਾਂ ਦਾ ਕੋਡ ਲਗਾ ਕੇ ਉਦਾਹਰਣ ਦੇ ਤੌਰ 'ਤੇ ਜ਼ੀਰੋ ਜ਼ੀਰੋ ਜ਼ੀਰੋ ਲਗਾ ਕੇ ਮੈਨੇ ਆਪਣਾ ਜਿਹੜਾ ਕੀ ਆ ਸਕਰੀਨ ਮੋਬਾਇਲ ਦੀ ਖੋਲ੍ਹ ਲਈ ਤਾਂ ਫਿਰ ਉਸ ਤੋਂ ਬਾਅਦ ਮੈਂ ਸਾਰੀਆਂ ਜਿਹੜੀਆਂ ਐਪਸ ਨੂੰ ਸਕਰੋਲ ਕਰਦਾ ਹੋਇਆ ਆਪਣੀ ਐਪ ਗੂਗਲ ਪੇਅ ਉੱਪਰ ਗਿਆ ਫੇਰ ਗੂਗਲ ਐਪ 'ਤੇ ਕਲਿੱਕ ਕਰਕੇ ਗੂਗਲ ਐਪ ਨੂੰ ਮੇਰਾ ਚਾਰ ਅੰਕਾਂ ਦਾ ਕੋਡ ਹੋਰ ਲੱਗਿਆ ਹੋਇਆ ਸੀ ਫਿਰ ਮੈਂ ਉਸ ਐਪ ਦੇ ਉੱਪਰ ਚਾਰ ਅੰਕਾਂ ਦਾ ਕੋਡ ਭਰ ਕੇ ਉਸ ਐਪ ਨੂੰ ਖੋਲ੍ਹਿਆ ਖੋਲ੍ਹਣ ਤੋਂ ਬਾਅਦ ਮੈਂ ਵੇਖਿਆ ਕਿ ਮੇਰੇ ਇਹਦੇ ਵਿੱਚ ਬੈਲੈਂਸ ਕਿੰਨਾ ਹੈ ਤਾਂ ਉਹ ਬੈਲੈਂਸ ਵੇਖਣ ਦੇ ਲਈ ਮੈਂ ਉਹਨੂੰ ਸਕਰੋਲ ਕਰਦਾ ਕਰਦਾ ਉਸ ਆਪਸ਼ਨ 'ਤੇ ਗਿਆ ਜਿੱਥੋਂ ਪਤਾ ਲੱਗ ਰਿਹਾ ਸੀ ਕਿ ਜਿਹੜਾ ਤੁਹਾਡਾ ਬੈਲੈਂਸ ਕਿੰਨਾ ਹੈ ਤਾਂ ਮੈਂ ਉਹ ਬੈਲੈਂਸ ਵਾਲੀ ਜਿਹੜੀ ਆਪਸ਼ਨ ਨੂੰ ਕਲਿੱਕ ਕੀਤਾ ਅਤੇ ਉਸ ਕਲਿੱਕ ਕਰਨ ਤੋਂ ਬਾਅਦ ਵੀ ਮੈਂ ਇੱਕ ਆਪਦਾ ਸੀਕਰੇਟ ਕੋਡ ਹੋਰ ਰੱਖਿਆ ਹੋਇਆ ਸੀ ਫਿਰ ਮੈਨੇ ਆਪਦਾ ਸੀਕਰੇਟ ਕੋਡ ਉੱਥੇ ਫਿੱਲ ਕੀਤਾ ਸੀਕਰੇਟ ਕੋਡ ਫਿੱਲ ਕਰਨ ਤੋਂ ਬਾਅਦ ਮੇਰਾ ਜਿਹੜਾ ਬਕਾਇਆ ਸੀ ਮੇਰਾ ਅਕਾਊਂਟ ਦੇ ਵਿੱਚ ਉਹ ਮੇਰੀ ਸਕਰੀਨ ਦੇ ਉੱਪਰ ਆ ਗਿਆ ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਮੇਰੇ ਕੋਲ ਇੰਨਾ ਹੈ ਬੈਲੈਂਸ ਹੈ ਤਾਂ ਹੁਣ ਮੈਂ ਆਪਦੇ ਜਿਹੜੇ ਔਨਲਾਈਨ ਸ਼ੂਅ ਆ ਜਿਹੜੇ ਖਰੀਦ ਸਕਦਾ ਗਾ ਤਾਂ ਮੇਰੇ ਅਕਾਊਂਟ ਦੇ ਵਿੱਚ ਜਿਹੜਾ ਪੰਜ ਹਜ਼ਾਰ ਰੁਪਏ ਸੀ ਅਤੇ ਜਦੋਂ ਕਿ ਜਿਹੜੀ ਮੈਂ ਸ਼ੌਪਿੰਗ ਕਰਨੀ ਸੀ ਔ ਅ ਸਿਰਫ ਪੰਦਰ੍ਹਾਂ ਸੌ ਰੁਪਏ ਦੀ ਹੀ ਕਰਨੀ ਸੀ ਇਸ ਤਰ੍ਹਾਂ ਮੈਂ ਉੱਥੋਂ ਬਾਹਰ ਹੁੰਦਾ ਹੋਇਆ ਉਸ ਐਪ ਦੇ ਉੱਪਰੋਂ ਬਾਹਰ ਹੋ ਕੇ ਬਾਹਰ ਆਇਆ ਫਿਰ ਮੈਂ ਗੂਗਲ ਕਰੋਮ ਦੇ ਵਿੱਚ ਐਮਾਜੋਨ ਦਾ ਜਿਹੜਾ ਅਕਾਊਂਟ ਆਪਣਾ ਖੋਲ੍ਹਿਆ ਉਸ ਦੇ ਅਕਾਊਂਟ ਖੋਲ੍ਹਣ ਤੋਂ ਬਾਅਦ ਫਿਰ ਮੈਨੇ ਸੂਅ ਸਰਚ ਕੀਤੇ ਜਿਸ ਕੰਪਨੀ ਦੇ ਮੈਂ ਲੈਣੇ ਸੀਗੇ ਉਸ ਕੰਪਨੀ ਦੇ ਜਿਹੜੇ ਸ਼ੂਅ ਸਰਚ ਕਰਨ ਤੋਂ ਬਾਅਦ ਮੇਰਾ ਜਿਹੜਾ ਸੱਤ ਨੰਬਰ ਸ਼ੂਅ ਮੇਰੇ ਆਉਂਦਾ ਉਹਨੂੰ ਮੈਂ ਕਲਿੱਕ ਕੀਤਾ ਕੰਪਨੀ ਮੈਨੇ ਰੈਡ ਟੇਪ ਦੇ ਲੈਣੇ ਸੀਗੇ ਰੈਡ ਟੇਪ ਨੂੰ ਕਲਿੱਕ ਕਰਕੇ ਸੱਤ ਨੰਬਰ ਸ਼ੂਅ ਮੇਰੇ ਆ ਗਏ ਤਾਂ ਮੈਨੇ ਦੇਖਿਆ ਵੀ ਇੰਨੇ ਰੁਪਏ ਦੇ ਆ ਅਤੇ ਉਹਦੇ 'ਤੇ ਪੇਮੈਂਟ ਪੁੱਛਦੇ ਸੀ ਕੈਸ਼ ਡਲੀਵਰੀ ਔਰ ਔਨਲਾਈਨ ਤਾਂ ਮੈਂ ਔਨਲਾਈਨ ਨੂੰ ਜਿਹੜਾ ਕੀ ਆ ਸਲੈਕਟ ਕੀਤਾ ਉਹਨੂੰ ਸਲੈਕਟ ਕਰਨ ਤੋਂ ਬਾਅਦ ਕੀ ਆ ਮੈਂ ਆਪਦੇ ਗੂਗਲ ਪੇਅ 'ਤੇ ਗਿਆ ਗੂਗਲ ਪੇਅ 'ਤੇ ਉਹਨਾਂ ਨੇ ਮੇਰੇ ਪੈਸੇ ਕੱਟੇ ਮੈਨੂੰ ਓ ਟੀ ਪੀ ਆਇਆ ਓ ਟੀ ਪੀ ਦੇ ਓ ਟੀ ਪੀ ਮੈਂ ਫਿੱਲ ਕੀਤਾ ਅਤੇ ਮੇਰਾ ਜਿਹੜਾ ਕੀ ਆ ਕੈਸ਼ ਦਾ ਭੁਗਤਾਨ ਹੋ ਗਿਆ ਅਤੇ ਉਹਨਾਂ ਵੱਲੋਂ ਵੀ ਸਕਸੈਸ ਆ ਗਿਆ ਅਤੇ ਮੇਰੀ ਪੇਮੈਂਟ ਪੂਰੀ ਹੋ ਗਈ ਸੀ ਆਫਟਰ ਥਰੀ ਡੇਜ ਮੈਨੂੰ ਜਿਹੜੇ ਕੀ ਆ ਮੇਰੇ ਸ਼ੂਅ ਮਿਲ ਗਏ ਸਨ ਤਾਂ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ